ਪੰਜਾਬ ਦੀ ਸਿਹਤ ਸਮੱਗਰੀ ਵਿੱਚ ਤਬਦੀਲੀ ਬਹੁਤ ਵੱਧ ਗਈ ਹੈ ਇਸ ਦੌਰਾਨ ਪੰਜਾਬ ਸਿਹਤ ਸੇਵਾਵਾਂ ਨੂੰ ਸੁਧਾਰ ਕੀਤਾ ਗਿਆ ਹੈ ਅਤੇ ਸਿਹਤ ਸਮੱਗਰੀ ਵਿੱਚ ਨਵਾਂ ਤਕਨੀਕੀ ਉਪਯੋਗ ਵੀ ਕੀਤਾ ਗਿਆ ਹੈ ਇਸ ਨਾਲ ਪੰਜਾਬ ਵਿੱਚ ਲੋਕਾਂ ਦੀ ਸਿਹਤ ਵੀ ਸੁਧਾਰੀ ਗਈ ਹੈ ਪਰ ਕੁਝ ਚੁਣੇ ਹਾਲਾਤਾਂ ਵਿੱਚ ਹਾਲਤ ਵੱਧ ਰਿਹਾ ਹੈ ਪੰਜਾਬ ਵਿੱਚ ਸਿਹਤ ਸੰਭਾਲ ਦੀ ਸਥਿਤੀ ਠੀਕ ਹੈ ਪਰ ਕੁਝ ਇਲਾਕਿਆਂ ਵਿੱਚ ਚੁਣੌਤੀਆਂ ਵੀ ਹਨ ਮੁਹੱਲਾ ਕ ਕਲੀਨਿਕਸ ਅਤੇ ਡਿਸਪੈਂਸਰੀਜ ਹਰ ਮੁਹੱਲੇ ਵਿੱਚ ਹਨ ਜੋ ਲੋਕਾਂ ਨੂੰ ਸਹੂਲਤ ਨਾਲ ਪਹੁੰਚ ਮਿਲ ਸਕਦੀ ਹੈ ਸਿਵਲ ਹਸਪਤਾਲਾਂ ਵਿੱਚ ਵਧੀਆ ਸਵਿਧਾਵਾਂ ਅਤੇ ਵਿਸ਼ੇਸ਼ ਇਲਾਜ ਉਪਲਬਧ ਹਨ ਪਰ ਕਈ ਵਾਰੀ ਸੰਸਥਾਪਨ ਦੀ ਕਮੀ ਅਤੇ ਮੈਨ ਪਾਵਰ ਦੀ ਵਾਧੂ ਲੋੜ ਹੈ ਇਸ ਕਾਰਨ ਸੁਧਾਰ ਦੀ ਲੋੜ ਹੈ ਮੁਹੱਲਾ ਕਲੀਨਿਕਸ ਮੁਹੱਲੇ ਵਿੱਚ ਸਥਿਤ ਹੋਣ ਵਾਲੀ ਕਲੀਨਿਕਸ ਹਨ ਜਿੱਥੇ ਲੋਕਾਂ ਨੂੰ ਸਧਾਰਨ ਇਲਾਜ ਦੀ ਸੇਵਾ ਮਿਲਦੀ ਹੈ ਇਹਨਾਂ ਵਿੱਚ ਅਮਲੇ ਦੀ ਸਿਖਲਾਈ ਅਤੇ ਦਵਾਈਆਂ ਦੀ ਸਿਹਤ ਸੁਵਿਧਾ ਮਿਲਦੀ ਹੈ ਡਿਸਪੈਂਸਰੀ ਡਿਸਪੈਂਸਰੀ ਦੀ ਵੀ ਮੁਹੱਲੇ ਵਿੱਚ ਹਨ ਜੋ ਮੁੱਖ ਸਿਹਤ ਕੇਂਦਰ ਦੇ ਤੌਰ 'ਤੇ ਕੰਮ ਕਰਦੀਆਂ ਹਨ ਇਹਨਾਂ ਵਿੱਚ ਵਧੀਆ ਸਧਾਰਨ ਇਲਾਜ ਦੀ ਸੁਗੰਧਤਾ ਹੁੰਦੀ ਹੈ ਸਿਵਲ ਹਸਪਤਾਲਾਂ ਸਿਵਲ ਹਸਪਤਾਲਾਂ ਪੰਜਾਬ ਵਿੱਚ ਵਿਆਹੀਤ ਸੁਵਿਧਾਵਾਂ ਅਤੇ ਸ਼ਪੈ ਸ਼ਪੈਸਲੀ ਇਲਾਜ ਦੇ ਲਈ ਜਾਣੇ ਜਾਂਦੇ ਹਨ ਇਹਨਾਂ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਸਿਹਤ ਸੁਵਿਧਾਵਾਂ ਦੀ ਸੁਗੰਧਤਾ ਹੁੰਦੀ ਹੈ ਅਤੇ ਵਧੀਆ ਇਲਾਜ ਦੀ ਸੇਵਾ ਮਿਲਦੀ ਹੈ